ਹਾਂਜੀ ਮੇਰੇ ਹਿਸਾਬ ਨਾਲ ਕਿਉਂਕਿ ਵੱਧ ਤੋਂ ਵੱਧ ਆਨਲਾਈਨ ਅਤੇ ਮੁਫਤ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਉਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਕਈ ਬੱਚੇ ਹੁੰਦੇ ਆ ਹੈ ਨਾ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਹੁੰਦੇ ਆ ਪਰ ਕਿਉਂਕਿ ਕਈ ਵਾਰੀ ਕਿਉਂਕਿ ਹਰ ਇੱਕ ਬੱਚਾ ਹਰ ਸਬਜੈਕਟ ਵਿੱਚ ਵਧੀਆ ਨਹੀਂ ਹੋ ਸਕਦਾ ਹੁਣ ਕਈ ਬੱਚੇ ਹੁੰਦੇ ਆ ਕਿ ਉਹ ਇੰਗਲਿਸ਼ ਪੰਜਾਬੀ ਸਾਇੰਸ ਸਭ ਕੁਝ ਵਧੀਆ ਹੁੰਦੇ ਪਰ ਮੈਥ ਵਿੱਚ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਹੈ ਨਾ ਤਾਂ ਉਹਨਾਂ ਦੇ ਘਰ ਦੇ ਮਤਲਬ ਕਿ ਉਹਨਾਂ ਲਈ ਟਿਊਸ਼ਨ ਵੀ ਨਹੀਂ ਅਫੋਰਡ ਕਰ ਸਕਦੇ ਹੁੰਦੇ ਹੈ ਨਾ ਕਿ ਉਹਨਾਂ ਦੀ ਮਤਲਬ ਆਰਥਿਕ ਸਥਿਤੀ ਉਸ ਮਤਲਬ ਕਿ ਕਾਬਲ ਨਹੀਂ ਹੁੰਦੀ ਕਿ ਉਹ ਟਿਊਸ਼ਨ ਰੱਖ ਸਕਣ ਹੈ ਨਾ ਤਾਂ ਇਸ ਲਈ ਕਿ ਆਨਲਾਈਨ ਮੇਰੇ ਹਿਸਾਬ ਨਾਲ ਬਹੁਤ ਵਧੀਆ ਇਹ ਮਤਲਬ ਕਿ ਬਹੁਤ ਵਧੀਆ ਹੋਊਗਾ ਜੇ ਉਹਨਾਂ ਨੂੰ ਵੱਧ ਤੋਂ ਵੱਧ ਸਟਡੀ ਮਟੀਰੀਅਲ ਪ੍ਰੋਵਾਈਡ ਹੋਵੇ ਹੈ ਨਾ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਜਿਵੇਂ ਆਪਾਂ ਨੂੰ ਵੈੱਬਸਾਈਟਸ ਵੀ ਪ੍ਰੋਵਾਈਡ ਹੋ ਜਾਂਦੀਆਂ ਨੇ ਜਿਵੇਂ ਸਟਡੀ ਟੂਨਾਈਟ ਮਤਲਬ ਕਿ ਹੈਗੀ ਆ ਹੈ ਨਾ ਮੈਂ ਆਲਮੋਸਟ ਸਟਡੀ ਉਹਦੇ ਤੋਂ ਹੀ ਕਰਦੀ ਹੁੰਦੀ ਹਾਂ ਜਾਂ ਫਿਰ ਆਪਣੇ ਹੋਰ ਵੀ ਬਹੁਤ ਜ਼ਿਆਦਾ ਵੈਬਸਾਈਟਸ ਆ ਆਪਾਂ ਨੂੰ ਅਵੇਲੇਬਲ ਹੈਗੀਆਂ ਨੇ ਗੂਗਲ 'ਤੇ ਯੂਟੀਊਬ 'ਤੇ ਤਾਂ ਆਪਣੇ ਮਤਲਬ ਕਿ ਬਹੁਤ ਹੀ ਜ਼ਿਆਦਾ ਸਟਡੀ ਲਈ ਮਟੀਰੀਅਲ ਹੈਗਾ ਵੀ ਹੈ ਬਹੁਤ ਵਧੀਆ ਸਮਝਾਉਂਦੇ ਆ ਹਰ ਇੱਕ ਭਾਸ਼ਾ ਵਿੱਚ ਆਪਾਂ ਨੂੰ ਮਟੀਰੀਅਲ ਮਿਲ ਜਾਂਦਾ ਹੈ ਨਾ ਤਾਂ ਮਤਲਬ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਹੈਗਾ ਵੱਧ ਤੋਂ ਵੱਧ ਸਟਡੀ ਮਟੀਰੀਅਲ ਬੱਚਿਆਂ ਨੂੰ ਪ੍ਰੋਵਾਈਡ ਹੁੰਦਾ ਜਿਹਦੇ ਨਾਲ ਕਿ ਉਹ ਬਹੁਤ ਬੱਚਿਆਂ ਦਾ ਫਾਇਦਾ ਹੁੰਦਾ ਹੈ ਨਾ ਕਈ ਵਾਰ ਕੋਈ ਬੱਚਾ ਹੁੰਦਾ ਕਿ ਉਹ ਆਪਣੀ ਸਟਡੀ ਰੈਗੂਲਰ ਵੀ ਨਹੀਂ ਕਰ ਸਕਦੇ ਹੁੰਦੇ ਗੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੇਨ ਪ੍ਰੋਬਲਮ ਸਭ ਦੀ ਕੀ ਆ ਆਰਥਿਕ ਸਥਿਤੀ ਹੈ ਨਾ ਆਰਥਿਕ ਸਥਿਤੀ ਕਰਕੇ ਕਈ ਬੱਚਿਆਂ ਨੂੰ ਕਿਉਂਕਿ ਬੇਚਾਰਿਆਂ ਨੂੰ ਆਪਣੀ ਜਿਹੜੀ ਸਟਡੀ ਹੈ ਨਾ ਉਹਨੂੰ ਅੱਧ ਦੇ ਵਿੱਚ ਛੱਡ ਕੇ ਜਾਂ ਉਹਨੂੰ ਨੋਨ ਅਟੈਂਡਿੰਗ ਕਰਕੇ ਅਤੇ ਮਤਲਬ ਕਿ ਜੋਬ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਹੈ ਨਾ ਅਤੇ ਮਤਲਬ ਕਿ ਕਿ ਫਿਰ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਗੇ ਕਿ ਉਹ ਟਿਊਸ਼ਨ ਮਤਲਬ ਰੱਖ ਸਕਣ ਹੈ ਨਾ ਵੀ ਉਹ ਆਪਦਾ ਘਰ ਦਾ ਖਰਚਾ ਚਲਾਉਣ ਕਿ ਟਿਊਸ਼ਨ ਰੱਖਣ ਹੈ ਨਾ ਇਹ ਵੀ ਇੱਕ ਪ੍ਰੋਬਲਮ ਹੋ ਜਾਂਦੀ ਹੈ ਇਸ ਲਈ ਕਿਉਂਕਿ ਜਦੋਂ ਆਪਣਾ ਆਨਲਾਈਨ ਮਟੀਰੀਅਲ ਪ੍ਰੋਵਾਈਡ ਹੋਊਗਾ ਤਾਂ ਕਿ ਉਹ ਉਹਨਾਂ ਬੱਚਿਆਂ ਦਾ ਬੇਚਾਰਿਆਂ ਦਾ ਬਹੁਤ ਫਾਇਦਾ ਹੋ ਜਾਂਦਾ ਵੀ ਹੈ ਨਾ ਉਹ ਆਪਣਾ ਫਰੀ ਟਾਈਮ ਕੱਢ ਕੇ ਆਪਣਾ ਇੱਕ ਲੈਕਚਰ ਕਵਰ ਕਰ ਸਕਦੇ ਆ ਇੱਕ ਆਪਣਾ ਟੋਪਿਕ ਕਵਰ ਹੈ ਨਾ ਐਵੇਂ ਕਿਉਂਕਿ ਟਾਈਮ ਬਚਾ ਬਚਾ ਕੇ ਹੋ ਕੇ ਆਪਣਾ ਸਿਲੇਬਸ ਕਵਰ ਕਰ ਸਕਦੇ ਇਹਦੇ ਨਾਲ ਕੀ ਹੈ ਉਹ ਆਪਣੀ ਸਟਡੀ ਨੂੰ ਅੱਧ ਵਿਚਕਾਰ ਉਹਨਾਂ ਨੂੰ ਛੱਡਣਾ ਨਹੀਂ ਪੈਂਦਾ ਹੈਗਾ ਅਤੇ ਮਤਲਬ ਉਹ ਆਪਦੀ ਸਟਡੀ ਨੂੰ ਕੰਟੀਨਿਊ ਕਰ ਸਕਦੇ ਆ